ਭੋਜਨ ਸਾਡੀ ਜ਼ਿੰਦਗੀ ਦਾ ਮੂਲ ਆਧਾਰ ਹੈ ਪਰ ਅੱਜ ਕੱਲ੍ਹ ਭੋਜਨ ਵਿੱਚ ਬਹੁਤ ਸਾਰੀਆਂ ਮਿਲਾਵਟਾਂ ਹੋਣ ਕਰਕੇ ਸਾਡੇ ਸਿਹਤ ਲਈ ਨੁਕਸਾਨਦਾਇਕ ਹਨ ਇਸ ਲਈ ਸਾਨੂੰ ਚਾਹੀਦਾ ਹੈ ਕਿ ਸਾਨੂੰ ਵੱਧ ਤੋਂ ਵੱਧ ਘਰ ਦੇ ਖਾਣਾ ਹੀ ਖਾਣਾ ਚਾਹੀਦਾ ਹੈ ਔਰਗੈਨਿਕ ਖਾਣਾ ਖਾਣਾ ਚਾਹੀਦਾ ਹੈ ਔਰਗੈਨਿਕ ਪਦਾਰਥ ਜਿਹੜੇ ਬਿਨਾਂ ਸਪਰੇਅ ਰੇਹ ਤੋਂ ਬਣੇ ਹੋਣ ਜਿਵੇਂ ਕਿ ਹੁਣ ਅਸੀ ਆਪਣੇ ਖੇਤਾਂ ਵਿੱਚ ਔਰਗੈਨਿਕ ਸਬਜ਼ੀਆਂ ਬੀਜ਼ੀਆਂ ਹਨ ਔਰ ਔਰਗੈਨਿਕ ਧਨੀਆ ਵਗੈਰਾ ਹੋ ਗਿਆ ਹੈ ਨਾ ਧਨੀਆ ਸੌਂਫ ਜਵੈਂਣ ਜਿਹੜੇ ਕਿ ਸਾਡੇ ਭੋਜਨ ਨੂੰ ਬਹੁਤ ਬਹੁਤ ਸਵਾਦਿਸ਼ਟ ਬਣਾਉਂਦੇ ਨੇ ਖ਼ਾਸ ਕਰਕੇ ਧਨੀਆ ਧਨੀਆ ਦਾ ਬਾਅਦ ਚੋਂ ਪਾਊਡਰ ਬਣਾ ਕੇ ਅਸੀ ਆਪਣੇ ਖਾਣੇ ਵਿੱਚ ਉਹਦਾ ਸੇਵਨ ਕਰਦੇ ਹਾਂ ਇਸ ਨਾਲ ਸਾਡੇ ਤਾਂ ਨਹੀ ਇਸ ਨਾਲ ਸਾਡੀ ਜਿਹੜੀ ਸਬਜ਼ੀ ਆ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੀ ਹੈ ਇਸ ਤੋਂ ਇਲਾਵਾ ਹਲਦੀ ਹਲਦੀ ਅੱਜ ਕੱਲ੍ਹ ਹਲਦੀ ਪਾਊਡਰ ਜਿਹੜਾ ਅੱਜ ਕੱਲ੍ਹ ਉਹਦੇ 'ਚ ਬਹੁਤ ਜ਼ਿਆਦਾ ਮਿਲਾਵਟ ਹੋ ਰਹੀ ਹੈ ਇਸ ਲਈ ਸਾਨੂੰ ਔਰਗੈਨਿਕ ਹਲਦੀ ਦੀ ਵਰਤੋਂ ਕਰਨੀ ਚਾਹੀਦੀ ਹੈ ਜਿਵੇਂ ਕਿ ਅਸੀ ਆਪਣੇ ਖੇਤਾਂ ਵਿੱਚ ਕਰਦੇ ਹਾਂ ਹਲਦੀ ਬਣਾਉਦੇ ਹਾਂ ਹਲਦੀ ਦੇ ਪੌਦੇ ਉਗਾਉਂਦੇ ਹਾਂ ਅਤੇ ਹਲਦੀ ਦੀ ਵਰਤੋਂ ਕਰਦੇ ਹਾਂ ਇਸ ਤਰ੍ਹਾਂ ਹੀ ਲਾਲ ਮਿਰਚਾਂ ਸਾਰੇ ਹੀ ਜਿਹੜੇ ਖੇਤ ਵਿੱਚ ਔਰਗੈਨਿਕ ਖੇਤੀ ਕੀਤੀ ਜਾਂਦੀ ਹੈ ਇਸ ਨਾਲ ਸਾਡੇ ਜਿਹੜੇ ਭੋਜਨ ਆ ਬਹੁਤ ਜ਼ਿਆਦਾ ਸਵਾਦਿਸ਼ਟ ਬਣਦੇ ਨੇ ਆਪਣੇ ਖੇਤੀ ਖੇਤ ਖੇਤੀਬਾੜੀ ਵਿੱਚ ਆਪਣੇ ਘਰ ਵਿੱਚ ਇਹ ਚੀਜ਼ਾਂ ਉਗਾਉਣੀਆਂ ਚਾਹੀਦੀਆਂ ਹਨ ਮਸਾਲੇ ਆਪਣੇ ਘਰ ਵਿੱਚ ਉਗਾਉਣੇ ਚਾਹੀਦੇ ਹਨ ਤਾਂ ਜੋ ਆਪਾਂ ਉਹਨੂੰ ਸ਼ੁੱਧ ਰੂਪ ਵਿੱਚ ਆਪਾਂ ਭੋਜਨ ਵਿੱਚ ਸੇਵਨ ਕਰ ਸਕੀਏ